ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਮਾਜਿਕ ਲਹਿਰ ਅਕਾਲੀ ਲਹਿਰ ਹੈ ਕਿਉਂਕਿ ਇਹਦੇ ਵਿੱਚ ਗੁਰੂ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਉਹਨਾਂ ਦੀ ਚਾਬੀਆਂ ਅਤੇ ਸੁਧਾਰ ਲਈ ਇਹ ਸਭ ਤੋਂ ਪਹਿਲਾਂ ਆਈ ਹੈ ਉਸ ਤੋਂ ਬਾਅਦ ਹੌਲੀ ਹੌਲੀ ਇਹਨਾਂ ਸੁਧਾਰ ਕੀਤਾ ਗੁਰਦੁਆਰਿਆਂ ਦੇ ਰਹਿਣ ਸਹਿਣ ਦਾ ਜਾਣੀ ਕਿ ਹਰੇਕ ਚੀਜ਼ ਦਾ ਵਿੱਚ ਇਹਨੇ ਲਹਿਰ ਨੇ ਮੁੱਖ ਪੰਜਾਬ ਵਿੱਚ ਬਹੁਤ ਜ਼ਿਆਦਾ ਜਣੀ ਕਿ ਯਤਨ ਕੀਤੇ ਵੀ ਆਧਾਰ ਲਈ ਇਸ ਤੋਂ ਬਾਅਦ ਇਹ ਹੌਲੀ ਹੌਲੀ ਅਕਾਲੀ ਜਾਣੀ ਕਿ ਅਕਾਲੀ ਪਾਰਟੀ ਬਣ ਗਈ ਜਾਣੀ ਕਿ ਪੋਲੀਟੀਕਲ 'ਚ ਆ ਗਈ ਅਤੇ ਪੋਲੀਟੀਕਲ ਵਿੱਚ ਆ ਕੇ ਨਾ ਚੋਣਾਂ ਲੜੀਆਂ ਜਾਣੀ ਕਿ ਕਾਫੀ ਜਾਣੀ ਕਿ ਸੁਧਾਰ ਆਇਆ ਜਾਣੀ ਕਿ ਸਭ ਤੋਂ ਜ਼ਿਆਦਾ ਮੁੱਖ ਮੁੱਖ ਲਹਿਰ ਅਕਾਲੀ ਹੈ